ਰਸੋਈ ਦਾ ਸਮਾਨ ਹਰੇਕ ਹੀ ਜ਼ਰੂਰੀ ਹੁੰਦਾ ਹੈ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਜਿਹੜੀ ਬਿਨਾਂ ਸਰ ਸਕਦਾ ਰ ਰਸੋਈ ਦਾ ਤਾਂ ਸਮਾਨ ਪੂਰਾ ਹੀ ਨਹੀਂ ਆ ਸਕਦਾ ਜਿਵੇਂ ਹੈਂਡੀ ਹੋਈ ਜਾਂ ਮਿਕਸੀ ਹੋਈ ਗਰਾਇੰਡ ਕਰਨ ਵਾਸਤੇ ਮਸਾਲਾ ਮਸੁਲਾ ਹੈ ਘੋਟਨਾ ਸਾਗ ਘੋਟਨਾ ਕੋਈ ਵੀ ਚੀਜ਼ ਬਣਾਉਣੀ ਮਸਾਲਾ ਕੁੱਟਣਾ ਮਿੰਟੋ ਮਿੰਟ ਭਾਂਡੇ ਚਿਮਟਾ ਵਾ ਚਿਮਟਾ ਕੜਛੀਆਂ ਕੁਛ ਵੀ ਅਤੇ ਸਮਾਨ ਹਰ ਤਰਾਂ ਦਾ ਗੈਸ ਚੁੱਲ੍ਹਾ ਤਵਾ ਚਿਮਟਾ ਹਰੇਕ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕੋਈ ਇਹੋ ਜਿਹੀ ਸਮਾਨ ਨਹੀਂ ਹੁੰਦਾ ਦਾ ਕਿਸੇ ਚੀਜ਼ ਬਿਨਾ ਨਹੀਂ ਸਰਦਾ ਹੁੰਦਾ ਕੋਈ ਵੀ ਚੀਜ਼ ਬਗੈਰ ਲੋੜ ਤੋਂ ਨਹੀਂ ਵਰਤੀ ਜਾਂਦੀ ਹਰ ਚੀਜ਼ ਦੀ ਲੋੜ ਹੁੰਦੀ ਰਸੋਈ 'ਚ ਤਾਂ ਜਿੰਨਾ ਸਮਾਨ ਹੋਵੇ ਉਨਾ ਹੀ ਥੋੜ੍ਹਾ ਕੋਈ ਚ ਵੱਧ ਤੋਂ ਵੱਧ ਚੀਜ਼ ਦੀ ਲੋੜ ਹੁੰਦੀ ਹੈ ਜਿਵੇਂ ਹੈਂਡੀ ਹੋ ਗਈ ਜੂਸਰ ਹੋ ਗਿਆ ਮਿਕਸੀ ਹੋ ਗਈ ਮਿਕਸੀ ਹੋ ਗਈ ਕੁੰਡਾ ਘੋਟਾ ਹੋ ਗਿਆ ਸਲੰਡਰ ਦੋ ਹੋਣੇ ਚਾਹੀਦੇ ਆ ਦ ਦੂਹਰੀਆਂ ਦੂਹਰੀਆਂ ਚੀਜ਼ਾਂ ਚਾਹੀਦੀਆਂ ਨੇ ਵੱਧ ਤੋਂ ਵੱਧ ਸਮਾਨ ਦੀ ਲੋੜ ਹੁੰਦੀ ਹੈ ਲੋੜ ਹੁੰਦੀ ਹੈ ਭਾਂਡੇ ਦਿੰਦੇ ਡਿਨਰ ਸੈੱਟ ਹੋ ਗਿਆ